ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਆਪਣੀਆਂ ਕੁਝ ਤਕਨੀਕਾਂ ਜਾਂ ਨੁਕਤੇ ਜੋ ਕਿ ਸਿੱਖੇ ਹਨ ਉਹਨਾਂ ਬਾਰੇ ਆਪਣੇ ਵਿਚਾਰ ਸਾਂਝੇ ਕਰਨੇ ਚਾਹਵਾਂਗੀ ਜਿਸ ਤਰ੍ਹਾਂ ਕਿ ਜਦੋਂ ਅਸੀਂ ਆਪਣੇ ਚਿੱਤਰਕਾਰੀ ਦੇ ਵਿੱਚ ਕਿਸੇ ਤਸਵੀਰ ਦੇ ਵਿੱਚ ਰੰਗ ਭਰ ਦਈਏ ਤਾਂ ਉਸ ਬੇਜਾਨ ਜਿਹੀ ਤਸਵੀਰ ਦੇ ਵਿੱਚ ਜਾਨ ਆ ਜਾਂਦੀ ਹੈ ਜਿਸ ਤਰ੍ਹਾਂ ਮੈਂ ਕਈ ਤਰੀਕੇ ਦੀਆਂ ਚੀਜ਼ਾਂ ਔਨਲਾਈਨ ਤੋਂ ਵੀ ਸਿੱਖੀਆਂ ਹਨ ਜਿਸ ਤਰ੍ਹਾਂ ਆਪਾਂ ਇੱਕ ਤਸਵੀਰ ਦੇ ਵਿੱਚ ਰੰਗ ਭਰਦੇ ਹਾਂ ਅਤੇ ਉਹ ਇੱਕ ਉੱਭਰ ਕੇ ਨਿਖੜਦੀ ਹੈ ਅਤੇ ਬੜੀ ਹੀ ਜ਼ਿਆਦਾ ਸੋਹਣੀ ਲੱਗਦੀ ਹੈ ਅਤੇ ਅੱਖਾਂ ਨੂੰ ਪ੍ਰਭਾਵਿਤ ਵੀ ਕਰਦੀ ਹੈ ਅਤੇ ਸਭ ਨੂੰ ਬੜੀ ਮਨ ਪਸੰਦ ਆਉਂਦੀ ਹੈ ਜੋ ਚੀਜ਼ਾਂ ਮੈਂ ਔਨਲਾਈਨ ਤੋਂ ਸਿੱਖੀਆਂ ਹਨ ਅਜੇ ਕੁਝ ਹੀ ਦਿਨ ਪਹਿਲੇ ਮੈਂ ਇੱਕ ਵੀਡੀਓ ਦੇਖ ਰਹੀ ਸੀ ਯੂਟਿਊਬ ਦੇ ਉੱਪਰ ਜਿਸ ਵਿੱਚ ਉਹਨਾਂ ਨੇ ਇੱਕ ਪੈਨਸਿਲ ਦੀ ਤਸਵੀਰ ਬਣਾਈ ਸੀ ਉਸ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਪਹਿਲਾਂ ਤਸਵੀਰ ਨੂੰ ਬਣਾਉਣ ਤੋਂ ਇੱਕ ਪੇਪਰ ਦੇ ਉੱਤੇ ਪੇਜ ਦੇ ਉੱਤੇ ਤੇਲ ਲਗਾ ਕੇ ਉਸਦੇ ਉੱਤੇ ਤਸਵੀਰ ਬਣਾਈ ਜਾਵੇ ਤਾਂ ਉਹ ਬੜੀ ਉਭਰ ਕੇ ਨਿਖੜਦੀ ਹੈ ਅਤੇ ਬੜੀ ਸੋਹਣੀ ਲੱਗਦੀ ਹੈ ਇਸ ਕਰਕੇ ਮੈਂ ਕਈ ਤਰੀਕੇ ਦੀਆਂ ਚੀਜ਼ਾਂ ਔਨਲਾਈਨ ਤੋਂ ਵੀ ਸਿੱਖਦੀ ਹਾਂ ਅਤੇ ਆਪਣੀ ਚਿੱਤਰਕਾਲੀ ਨੂੰ ਪੇਸ਼ ਕਰਦੀ ਹਾਂ ਧੰਨਵਾਦ